ਹਰ ਇੱਕ ਧਰਮ ਦਾ ਆਪਣੇ ਆਪਣੇ ਅਧਿਆਤਮਿਕ ਗੁਰੂ ਹੁੰਦੇ ਨੇ ਆਪਣਾ ਆਪਣਾ ਧਰਮ ਉਹ ਮੰਨਦੇ ਨੇ ਪਰ ਮੈਂ ਆਪਣੀ ਜੇ ਗੱਲ ਕਰਾਂ ਤਾਂ ਮੈਂ ਇੱਕ ਸਿੱਖ ਧਰਮ ਤੋਂ ਬਿਲੋਂਗ ਕਰਦੀ ਹਾਂ ਅਤੇ ਜੋ ਮੇਰੇ ਅਧਿਆਤਮਿਕ ਗੁਰੂ ਜਿਨ੍ਹਾਂ ਨੂੰ ਮੈਂ ਮੰਨਦੀ ਹਾਂ ਉਹ ਗੁਰੂ ਨਾਨਕ ਦੇਵ ਜੀ ਨੇ ਅਤੇ ਮੈਂ ਹਮੇਸ਼ਾ ਗੁਰਦੁਆਰੇ ਹੀ ਜਾਂਦੀ ਹਾਂ ਮੈਂ ਸਾਰੇ ਰਿਲੀਜ਼ਨ ਦਾ ਰਿਸਪੈਕਟ ਕਰਦੀ ਹਾਂ ਪਰ ਮੈਂ ਜ਼ਿਆਦਾਤਰ ਸਿੱਖ ਹੋਣ ਕਰਕੇ ਮੈਂ ਜ਼ਿਆਦਾ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਗੁਰੂ ਮੰਨਦੀ ਹਾਂ ਕਿਉਂਕਿ ਉਹਨਾਂ ਨੇ ਕਦੇ ਵੀ ਕਿਸੇ ਵੀ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਸੀ ਸਾਰਿਆਂ ਨੂੰ ਸੱਚ ਦੇ ਰਾਹ 'ਤੇ ਚੱਲਣ ਦਾ ਰਸਤਾ ਦਿਖਾਇਆ ਸੀ ਕਿਸੇ ਨੂੰ ਧੋਖਾ ਨਹੀਂ ਕਿਸੇ ਨਾਲ਼ ਠੱਗੀ ਨਹੀਂ ਕਰਨੀ ਉਹਨਾਂ ਨੇ ਇਹ ਸਿੱਖਿਆਵਾਂ ਦਿੱਤੀਆਂ ਸੀ ਉਹਨਾਂ ਨੇ ਕਈ ਉਦਾਸੀਆਂ ਕੀਤੀਆਂ ਸੀਗੀਆਂ ਅਤੇ ਜਿਹੜੇ ਆਪਾਂ ਹੁਣ ਗੁਰੂ ਨਾਨਕ ਦੇਵ ਜੀ ਜੋ ਹੈ ਜਿਹੜੇ ਸਿੱਖਾਂ ਦੇ ਪਹਿਲੇ ਗੁਰੂ ਮੰਨੇ ਜਾਂਦੇ ਨੇ ਜਿਹੜੇ ਸਿੱਖਾਂ ਦੇ ਦਸਵੇਂ ਗੁਰੂ ਹਨ ਗ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਕਿਹਾ ਸੀ ਕਿ ਵੀ ਉਹਨਾਂ ਨੇ ਆਪਣੇ ਉਸ ਟਾਈਮ ਵਿੱਚ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਅਸਲੀ ਗੁਰੂ ਨੇ ਇਸ ਤੋਂ ਉੱਤੇ ਹੋਰ ਕਿਸੇ ਵੀ ਗੁਰੂ ਨੂੰ ਨਹੀਂ ਮੰਨਿਆ ਜਾਵੇਗਾ ਅਤੇ ਮੈਂ ਹਮੇਸ਼ਾ ਗੁਰਦੁਆਰੇ ਜਾ ਕੇ ਜੇ ਆਪਣੀ ਅਰਦਾਸ ਕਰਦੀ ਹਾਂ ਅਤੇ ਵੀ ਸਾਰੇ ਸੁੱਖ ਸ਼ਾਂਤੀ ਹੋਵੇ ਪਰ ਜੇਕਰ ਕਦੇ ਮੈਂ ਉਦਾਸ ਹੁੰਦੀ ਹਾਂ ਮੇਰਾ ਮਨ ਡੋਲ ਜਾਂਦਾ ਹੈ ਤਾਂ ਮੈਂ ਆਪਣਾ ਪਾਠ ਕਰਦੀ ਹਾਂ ਜਾਂ ਗੁਰਦੁਆਰੇ ਜਾ ਕੇ ਆਪਣੇ ਮਨ ਨੂੰ ਸ਼ਾਂਤੀ ਦਿਵਾਉਂਦੀ ਹਾਂ ਅਤੇ ਮੈਨੂੰ ਇਹ ਚੀਜ਼ ਆਪਣੀ ਬਹੁਤ ਵਧੀਆ ਲੱਗਦੀ ਹੈ ਕਿ ਸਾਨੂੰ ਆਪਣੇ ਬੁਰੇ ਟਾਈਮ ਵਿੱਚ ਰੱਬ ਨੂੰ ਧਿਆਉਣਾ ਚਾਹੀਦਾ ਹੈ ਆਪਣੇ ਬੁਰੇ ਟਾਈਮ ਵਿੱਚ ਰੱਬ ਨੂੰ ਯਾਦ ਕਰਨਾ ਚਾਹੀਦਾ ਹੈ ਕਿਉਂਕਿ ਹਮੇਸ਼ਾ ਜੋ ਆਪਣੇ ਨਾਲ਼ ਚੱਲਣਾ ਉਹ ਸਿਰਫ਼ ਰੱਬ ਹੀ ਹੈ ਜਿਹੜਾ ਆਪਣੇ ਨਾਲ਼ ਅੱਗੇ ਜਾਵੇਗਾ ਅਤੇ ਕੋਈ ਵੀ ਨਹੀਂ ਜਾਵੇਗਾ ਆਪਣੇ ਨਾਲ਼ ਅਤੇ ਹਮੇਸ਼ਾ ਆਪਣੇ ਨਾਲ਼ ਰੱਬ ਹੀ ਰਹੇਗਾ ਤਾਂ ਕਰਕੇ ਮੈਂ ਆਪਣਾ ਅਧਿਆਤਮਿਕ ਗੁਰੂ ਉਹਨਾਂ ਨੂੰ ਹੀ ਮੰਨਦੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਦੀ ਹਾਂ ਅਤੇ ਮੈਨੂੰ ਬਹੁਤ ਹੀ ਜ਼ਿਆਦਾ ਉਹਨਾਂ ਦਾ ਨਾਮ ਜਪਣ ਨਾਲ਼ ਮੇਰੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲਦੀ ਹੈ